ਹੈਲੋ ਮੈਮ ਮੈਂ ਨਾ ਮੇਰਾ ਘਰ ਬਣ ਰਿਹਾ ਅਤੇ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰਨੀ ਸੀ ਕਿ ਮੇਰਾ ਜਿਹੜਾ ਆਊਟਡੋਰ ਸਪੇਸ ਹੈ ਉਹ ਮੈਂ ਕਿਸ ਤਰ੍ਹਾਂ ਰੱਖਾਂ ਉਹਦੇ ਵਿੱਚ ਕੀ ਕੰਮ ਕਰਾਵਾਂ ਔਰ ਜਿਹੜਾ ਮੇਰਾ ਗਾਰਡਨ ਹੈ ਉਹਨੂੰ ਮੈਂ ਕਿਸ ਤਰ੍ਹਾਂ ਰੱਖਾਂ ਕੀ ਮੇਰਾ ਜੋ ਘਰ ਦਾ ਆਊਟ ਸਪੇਸ ਹੈ ਉਹ ਵੀ ਕਵਰ ਹੋ ਜੇ ਔਰ ਉਹ ਜਿਹੜਾ ਲੁੱਕ ਹੈ ਮੇਰੇ ਘਰ ਦੀ ਅੱਛੀ ਬਣ ਜੇ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਸੋਚ ਰਹੀ ਸੀ ਕਿ ਮੈਮ ਉਹਨਾਂ ਨੂੰ ਜੇਕਰ ਕੈਪਸੂਲ ਕੈਪਸੂਲ ਸ਼ੇਪ ਬਣਾ ਦੀਏ ਨਾ ਕਿਉਂਕਿ ਉਹ ਜਿਹੜੀ ਸਪੇਸ ਹੈ ਨਾ ਉਹ ਹੈਗੀ ਇਸ ਤਰਾਂ ਕਿ ਉਹਨੂੰ ਅਗਰ ਆਪਾਂ ਕੈਪਸੂਲ ਸਾਈਜ਼ 'ਚ ਬਣਾਉਂਦੇ ਕੈਪਸੂਲ ਟਾਈਪ 'ਚ ਤਾਂ ਉਹਦੇ ਲੁੱਕ ਅੱਛੀ ਆ ਜਾਏਗੀ ਹਾਂਜੀ ਹਾਂ ਹੋਰ ਮੈਂ ਉਹਦੇ ਵਿੱਚ ਕੀ ਕਰ ਸਕਦੀ ਹਾਂ ਮੈਂ ਸੋ ਹਾਂ ਠੀਕ ਐਵੇ ਕਰ ਸਕਦੇ ਆ ਪੇਂਟ ਕਰਦੀ ਹੈ ਨਾ ਮਟਕੇ ਪੇਂਟ ਕਰਾ ਕੇ ਰਖਾ ਦਿੰਦੇ ਹਾਂ ਹਾਂਜੀ ਜਿਵੇਂ ਸਪੂਨਸ ਨੂੰ ਵੀ ਫਿਰ ਪੇਂਟ ਕਰਾ ਕੇ ਰਖਾ ਦਿੰਦੇ ਹਾਂ ਔਰ ਫਿਰ ਬਾਕੀ ਜਿਹੜੇ ਗਮਲੇ ਵਗੈਰਾ ਰੱਖ ਦਿਆਂਗੇ ਜਾਂ ਪੇੜ ਪੇੜ ਤਾਂ ਤੁਹਾਨੂੰ ਨੌਲੇਜ ਹੈ ਕਿ ਕਿਵੇਂ ਵਾਲੇ ਪੇੜ ਉਥੇ ਅੱਛੇ ਲੱਗਣਗੇ ਉਹ ਤੁਸੀਂ ਮੈਨੂੰ ਦੱਸ ਦਿਓ ਵੀ ਕਿਹੜੇ ਵਾਲੇ ਪੇੜ ਆਪਾਂ ਉਥੇ ਲਗਾ ਸਕਦੇ ਹਾਂ ਹਾਂਜੀ ਹਾਂਜੀ ਕਿਉਂਕਿ ਪੇੜ ਕਿਹੜਾ ਵਾਲਾ ਉੱਥੇ ਠੀਕ ਰਹੇਗਾ ਉਹ ਤਾਂ ਵੇਖ ਕੇ ਪਤਾ ਚੱਲੇਗਾ ਅੱਛਾ ਅਤੇ ਜਿਹੜਾ ਆਊਟਡੋਰ ਸਪੇਸ ਹੈ ਉਹਦੇ ਵਿੱਚ ਵੀ ਥੋੜ੍ਹੀ ਡੈਕੋਰੇਸ਼ਨ ਦੀ ਗੱਲ ਕਰ ਰਹੇ ਸੀ ਕਿ ਮੈਨੂੰ ਥੋੜ੍ਹਾ ਇਹ ਵੀ ਡਾਊਟ ਸੀਗਾ ਕਿ ਲੈਫਟ ਰਾਈਟ 'ਚ ਪਾਰਕ ਰੱਖਾਂ ਕਿਹੜੀ ਸਾਈਡ ਪਾਰਕ ਰੱਖਾਂ ਤਾਂ ਉਹ ਚੀਜ਼ ਜਿਹੜੀ ਆ ਉਹ ਤੁਸੀਂ ਆ ਕੇ ਦੇਖ ਕੇ ਮੈਨੂੰ ਦੱਸਿਓ ਜਾ ਮੈਂ ਤੁਹਾਨੂੰ ਆਪਦੇ ਘਰ ਦਾ ਨਕਸ਼ੇ ਨਕਸ਼ਾ ਭੇਜੂਗੀ ਅਤੇ ਤੁਸੀਂ ਦੱਸਣਾ ਕਿ ਹਾਂ ਇਹਦੇ ਵਿੱਚ ਇਥੇ ਤੁਹਾਡਾ ਪਾਰਕ ਹੋਣਾ ਚਾਹੀਦਾ ਹਾਂਜੀ ਅਤੇ ਬਾਕੀ ਹਾਂਜੀ ਔਰ ਜਿਹੜਾ ਕਹਿ ਲਓ ਕਿ ਆਊਟਡੋਰ ਸਪੇਸ ਆ ਉਹ ਵੀ ਥੋੜ੍ਹਾ ਅੱਛਾ ਬਚ ਜੇ ਕਿਉਂਕਿ ਉਹ ਵੀ ਜ਼ਰੂਰੀ ਹੁੰਦਾ ਕਿ ਸੰਡੇ ਦੇ ਵਿੱਚ ਅਗਰ ਧੁੱਪ ਧੁੱਪ 'ਤੇ ਬੈਠਣਾ ਹੋਏ ਤਾਂ ਉਹ ਈਜ਼ੀਲੀ ਤੁਸੀਂ ਚੇਅਰਸ ਲਗਾ ਕੇ ਜਾਂ ਕਦੇ ਚਾਏ ਬਾਏ ਪੀਣੀ ਹੋਵੇ ਤਾਂ ਆਰਾਮ ਨਾਲ ਬੰਦਾ ਬਾਹਰ ਬੈਠ ਕੇ ਕਰ ਸਕਦਾ ਹੈ ਇਹ ਸਭ ਹਾਂਜੀ ਹਾਂਜੀ ਕਰੀ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਫਿਰ ਮੈਮ ਤੁਸੀਂ ਮਿਲੋਗੇ ਤਾਂ ਆਪਾਂ ਕਰਾਂਗੇ ਗੱਲ ਠੀਕ ਹੈ ਜੀ ਓਕੇ ਜੀ ਠੀਕ ਹੈ ਜੀ ਠੀਕ ਓਕੇ